ਕੀ ਮੈਂ ਆਪਣੇ ਲੈਂਡਲਾਈਨ ਬਿੱਲ ਦਾ ਭੁਗਤਾਨ ਕਿਸੀ ਤੀਜੀ ਦੇ ਰਾਹੀਂ ਕੀਤਾ ਹੈ ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਮੇਰਾ ਬਿਲ ਜਮ੍ਹਾਂ ਹੋਇਆ ਜਾਂ ਨਹੀਂ ਮੈਂ ਗ੍ਰਾਹਕ ਸਹਾਇਤਾ ਨਾਲ ਸੰਪਰਕ ਕੀਤਾ ਮੈਂ ਪਤਾ ਕਰਨਾ ਚਾਹੁੰਦੀ ਹਾਂ ਕਿ ਮੇਰਾ ਬਿੱਲ ਜਮ੍ਹਾਂ ਹੋ ਗਿਆ ਜਾਂ ਨਹੀਂ ਮੈਂ ਤੁਹਾਨੂੰ ਆਪਣਾ ਪੂਰਾ ਵੇਰਵਾ ਦਿੰਦੀ ਹਾਂ ਮੇਰਾ ਨਾਮ ਰੇਨੂੰ ਬਿੱਲ ਨੰਬਰ ਇੱਕ ਪੰਜ ਦੋ ਜੀਰੋ ਮਿਤੀ ਦਸ ਤਿੰਨ ਦੋ ਹਜ਼ਾਰ ਪੱਚੀ ਸਮੇਂ ਦਸ ਵੱਜ ਕੇ ਵੀਹ ਮਿੰਨਟ ਤੁਸੀਂ ਮੈਨੂੰ ਦੱਸੋ ਕਿ ਮੇਰਾ ਬਿੱਲ ਸਫਲਤਾ ਪੂਰਵਕ ਜਮ੍ਹਾਂ ਹੋ ਗਿਆ ਜਾਂ ਕੋਈ ਲੈਣ ਦੇਣ 'ਚ ਸਮੱਸਿਆ ਆਈ ਹੈ ਜਾਂ ਕੋਈ ਹੋਰ ਸਮੱਸਿਆ ਆਈ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਆਈ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ ਪਤਾ ਕਰਕੇ ਦੱਸੋ ਕਿ ਕੀ ਸਮੱਸਿਆ ਆਈ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਫਿਰ ਪੂਰੀ ਤਰ੍ਹਾਂ ਨਾਲ ਜਾਣਕਾਰੀ ਦਿਓਗੇ ਤਾਂ ਕਿ ਮੈਨੂੰ ਅੱਗੇ ਤੋਂ ਇੱਦਾਂ ਦੀ ਕੋਈ ਸਮੱਸਿਆ ਨਾ ਆਵੇ ਤਾਂ ਤਾਂ ਮੈਂ ਆਪਣਾ ਬਿੱਲ ਅੱਛੀ ਤਰ੍ਹਾਂ ਜਮ੍ਹਾਂ ਕਰਵਾ ਸਕਾਂ ਧੰਨਵਾਦ